ਦਸ ਮਾਰਚ ਉੱਨੀ ਸੌ ਪਝੱਤਰ ਉੱਨੀ ਜੁਲਾਈ ਉੱਨੀ ਸੌ ਛਿਹੱਤਰ ਪੰਦਰਾਂ ਅਗਸਤ ਦੋ ਹਜ਼ਾਰ ਇੱਕ ਜਨਵਰੀ ਉੱਨੀ ਸੌ ਚੁਰੰਜਾ ਇੱਕ ਨਵੰਬਰ ਉੱਨੀ ਸੌ ਉਣੰਜਾ